ਹੈਲੋ ਸਤਿ ਸ਼੍ਰੀ ਅਕਾਲ ਮੈਮ ਕਿਆ ਹਾਲ ਚਾਲ ਵਧੀਆ ਮੈਮ ਵੈਸੇ ਨਾ ਮੇਰੀ ਨਾ ਸ਼ਾਦੀ ਆ ਫੋਰ ਮਾਰਚ ਤੋਂ ਤੋ ਮੈਨੇ ਨਾ ਆਪਕੋ ਬੁੱਕ ਕਰਵਾਨਾ ਮੇਰਾ ਫੋਰ ਮਾਰਚ ਚਾਰ ਮਾਰਚ ਹਾਂਜੀ ਤੁਸੀਂ ਦੱਸ ਦਿਓ ਕਿ ਕੀ ਉਹਦੇ ਮੈਨੂੰ ਰੋਇਲ ਵਿਆਹ ਚਾਹੀਦਾ ਤੁਸੀਂ ਦੱਸੋ ਕਿੰਨੇ ਪੈਸੇ ਲਓਗੇ ਕਿ ਕਿੰਝ ਡੈਕੋਰੇਟ ਕਰੋਗੇ ਕਿੱਦਾਂ ਦੇ ਫਲਾਵਰਸ ਲਗਾਓਗੇ ਦੇਖ ਲੈਣਾ ਲਿੱਲੀ ਜਾਂ ਕੋਈ ਹੋਰ ਵਧੀਆ ਫਲਾਵਰਸ ਲਗਾ ਦੇਣਾ ਚਲੋ ਠੀਕ ਆ ਓਕੇ ਓਕੇ ਸਤਿ ਸ਼੍ਰੀ ਅਕਾਲ